ਦੋ ਦਸੰਬਰ ਦੋ ਹਜ਼ਾਰ ਅਠਾਰ੍ਹਾਂ ਤੀਹ ਅਗਸਤ ਦੋ ਹਜ਼ਾਰ ਸੱਤ ਇੱਕ ਜਨਵਰੀ ਉੱਨੀ ਸੌ ਛਿਆਲੀ ਪੰਜ ਮਾਰਚ ਦੋ ਹਜ਼ਾਰ ਬਾਰ੍ਹਾਂ ਸਤਾਈ ਮਈ ਦੋ ਹਜ਼ਾਰ ਅੱਠ